ਅ ਰੇਲ ਇਕ ਸਭ ਤੋਂ ਵਧੀਆ ਮੀਨ ਆਫ ਟਰਾਂਸਪੋਰਟ ਹੈ ਇਹ ਤੋਂ ਆਪਾਂ ਦੇਸ਼ ਦੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਕਿਤੇ ਵੀ ਸਫ਼ਰ ਕਰ ਸਕਦੇ ਹਾਂ ਅਤੇ ਇਹਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਹੁੰਦੀਆਂ ਹਨ ਇਹਦੇ ਵਿੱਚ ਅਸੀਂ ਖਾ ਮਤਲਬ ਖਾ ਵੀ ਸਕਦੇ ਹਾਂ ਅਸੀਂ ਪੀ ਵੀ ਸਕਦੇ ਹਾਂ ਅਤੇ ਕਿਤੇ ਕਿਤੇ ਇਹ ਬਹੁਤ ਵਧੀਆ ਇਹ ਬਹੁਤ ਸਭ ਤੋਂ ਸੁਖਦ ਮੋਡ ਆਫ ਟਰਾਂਸਪੋਰਟ ਹੈ ਅਤੇ ਇਹਨੂੰ ਹਰ ਇੱਕ ਹ ਇਹਨੂੰ ਹ ਆਮ ਆਦਮੀ ਵੀ ਅਫੋਡ ਕਰ ਸਕਦਾ ਹੈ ਸੀ ਜਿੱਥੇ ਤੱਕ ਇਹਦੀਆਂ ਸੀਟਾਂ ਦੀਆਂ ਗੱਲ ਸੀਟਾਂ ਦੀ ਗੱਲ ਕੀਤੀ ਜਾਵੇ ਇਹ ਇਹਦੀਆਂ ਸੀਟਾਂ ਬਹੁਤ ਕੰਫਰਟੇਬਲ ਹੁੰਦੀਆਂ ਹਨ ਫਿਰ ਉਹਦੇ ਬਾਅਦ ਜੇ ਆਪਾਂ ਇਹਦੀ ਬਰਥ ਦੀ ਗੱਲ ਕੀਤੀ ਜਾਵੇ ਤਾਂ ਬਰਥ ਸਲੀਪਰ ਕਲਾਸ ਦੇ ਵਿੱਚ ਅਸੀਂ ਸੌ ਵੀ ਸਕਦੇ ਹਾਂ ਅਸੀਂ ਹਰ ਇੱਕ ਚੀਜ਼ ਕਰ ਸਕਦੇ ਹਾਂ ਜੋ ਕਿ ਅਸੀਂ ਸਫ਼ਰ ਦੇ ਵਿੱਚ ਕਰਦੇ ਹਾਂ ਆਪਾਂ ਸੌ ਵੀ ਸਕਦੇ ਹਾਂ ਆਪਾਂ ਜਾਗ ਵੀ ਸਕਦੇ ਹਾਂ ਇੰਜਨ ਇੰਜਨ ਟ੍ਰੇਨ ਦਾ ਇੱਕ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਹੈ ਜਿਹੜਾ ਕਿ ਉਹਨੂੰ ਖਿੱਚਦਾ ਹੈ ਅਤੇ ਇਹਦੇ ਨਾਲ ਕੀ ਟ੍ਰੇਨ ਚਲਦੀ ਹੈ ਅਤੇ ਇਹ ਸਫ਼ਰ ਨੂੰ ਬਹੁਤ ਵਧੀਆ ਤਰੀਕੇ ਨਾਲ ਸਫ਼ਰ ਬਹੁਤ ਵਧੀਆ ਤਰੀਕੇ ਨਾਲ ਲੰਘ ਜਾਂਦਾ ਹੈ ਜਿਹੜਾ ਸਫ਼ਰ ਕਿ ਸਾਨੂੰ ਅੱਠ ਘੰਟੇ ਦਾ ਪੈਂਦਾ ਹੈ ਟ੍ਰੇਨ ਕਰਕੇ ਸਾਨੂੰ ਸਾਰਾ ਪੰਜ ਘੰਟੇ ਦਾ ਲੱਗਦਾ ਹੈ ਅਤੇ ਇਹਦੇ ਇਹਦੇ ਟਰੈਕ ਕਿਤੇ ਕਿਤੇ ਜਾ ਕੇ ਜੁੜ ਵੀ ਜਾਂਦੇ ਹਨ ਅਤੇ ਇਹ ਹਰ ਇੱਕ ਸਟੇਸ਼ਨ 'ਤੇ ਰੁਕਦੀ ਹੈ